ਮੈਂ ਬੁਣਾਈ ਸਿਲਾਈ ਆਪਣੀ ਬਚਪਨ ਤੋਂ ਹੀ ਸ਼ੁਰੂ ਕੀਤੀ ਜਦੋਂ ਮੈਂ ਆਪਣੀ ਦਾਦੀ ਜੀ ਨੂੰ ਦੇਖਦੀ ਸਾਂ ਬੁਣਾਈ ਕਰਦੇ ਹੋਏ ਤਾਂ ਮੈਨੂੰ ਬਹੁਤ ਵਧੀਆ ਲੱਗਦਾ ਸੀ ਕਿ ਮੈਂ ਵੀ ਕਰਾਂ ਇਸ ਕਰਕੇ ਦੇਖ ਦੇਖ ਕੇ ਮੇਰੇ ਦਿਲ ਵਿੱਚ ਵੀ ਸ਼ੌਂਕ ਪੈਦਾ ਹੋਇਆ ਅਤੇ ਮੈਂ ਬੁਣਾਈ ਸਿਲਾਈ ਸ਼ੁਰੂ ਕਰ ਦਿੱਤੀ ਸ਼ੁਰੂ ਸ਼ੁਰੂ ਵਿੱਚ ਮੈਂ ਲੱਡੂ ਗੋਪਾਲ ਦੇ ਕੱਪੜੇ ਬਣਾਉਣੇ ਸ਼ੁਰੂ ਕੀਤੇ ਕਰੋਸ਼ੀਏ ਅਤੇ ਫਿਰ ਮੈਂ ਮਸ਼ੀਨ 'ਤੇ ਵੀ ਕੱਪੜੇ ਸਿਲਾਈ ਕੀਤੇ ਉਹਨਾਂ ਦੇ ਹੌਲੀ ਹੌਲੀ ਮੇਰੀ ਦਿਲਚਸਪੀ ਵਧਦੀ ਗਈ ਤਾਂ ਮੇਰੇ ਹੱਥ ਦੀ ਸਫਾਈ ਬਹੁਤ ਵੱਧ ਗਈ ਤਾਂ ਮੇਰੇ ਦਿਲ ਵਿੱਚ ਸ਼ੌਂਕ ਪੈਦਾ ਹੋਇਆ ਕਿ ਮੈਂ ਹੁਣ ਕੁਛ ਕੰਮ ਵੀ ਕਰਾਂ ਹੌਲੀ ਹੌਲੀ ਮੈਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਤਾਂ ਮੈਂ ਸੂਟ ਸਟਿਚ ਕਰਨੇ ਸ਼ੁਰੂ ਕਰ ਦਿੱਤੇ ਤਾਂ ਮੈਨੂੰ ਬਹੁਤ ਵਧੀਆ ਸਹਿਯੋਗ ਮਿਲਿਆ ਤਾਂ ਮੇਰਾ ਸ਼ੌਂਕ ਹੋਰ ਵੱਧ ਗਿਆ ਇਹ ਮੇਰੀ ਕਮਾਈ ਦਾ ਸਾਧਨ ਵੀ ਸੀ ਮੇਰਾ ਸ਼ੌਂਕ ਵੀ ਸੀ ਜਿਸ ਕਰਕੇ ਮੈਨੂੰ ਬੁਣਾਈ ਸਿਲਾਈ ਬਹੁਤ ਵਧੀਆ ਲੱਗਦੀ ਸੀ ਅੱਜ ਮੈਂ ਇਹ ਕੰਮ ਕਰਕੇ ਆਪਣੇ ਪੈਰਾਂ 'ਤੇ ਸਟੈਂਡ ਹਾਂ ਤਾਂ ਮੈਨੂੰ ਇਹ ਕੰਮ ਬਹੁਤ ਵਧੀਆ ਲੱਗਦਾ ਹੈ